ਹਾਂਜੀ ਫਲਿਪਕਾਰਟ ਤੋਂ ਬੋਲ ਰਹੇ ਹੋ ਹਾਂਜੀ ਮੇਰਾ ਨਾਮ ਰਿਤੂ ਹੈ ਹਾਂ ਮੈਂ ਥੋੜ੍ਹੇ ਦਿਨ ਪਹਿਲੇ ਨਾ ਤੁਹਾਡੇ ਕੋਲ ਚਾਰਜਰ ਮੰਗਵਾਏ ਸੀ ਦੋ ਹਾਂਜੀ ਹਾਂਜੀ ਹਾਂਜੀ ਔਰ ਮੈਂ ਤਾਂ ਪਹਿਲਾਂ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਂ ਕਾਫੀ ਦਿਨਾਂ ਤੋਂ ਮੰਗਵਾਏ ਸੀ ਔਡਰ ਦਿੱਤ ਔਡਰ ਕੀਤਿਆ ਕਾਫੀ ਟਾਈਮ ਹੋ ਗਿਆ ਸੀ ਪਹੁੰਚੇ ਮੈਨੂੰ ਕਾਫੀ ਲੇਟ ਹੈ ਇਹ ਦੋ ਕੁ ਦਿਨ ਪਹਿਲੇ ਮੈਨੂੰ ਪਹੁੰਚੇ ਆ ਦੂਸਰੀ ਗੱਲ ਹੈ ਕਿ ਜਿਹੜਾ ਤੁਹਾਡਾ ਸੀਗਾ ਆਇਆ ਸੀ ਬੰਦਾ ਉਹਦਾ ਬਿਹੇਵੀਅਰ ਬਹੁਤ ਰੂਡਲੀ ਬੋਲਿਆ ਮੇਰੇ ਨਾਲ ਕਿਸੇ ਨੂੰ ਭੇਜਣਾ ਹੁੰਦਾ ਤਾਂ ਅੱਛਾ ਵਿਹਾਰ ਹੋਣਾ ਚਾਹੀਦਾ ਵਾ ਉਹਨਾਂ ਕਸਟਮਰ ਨਾਲ ਕਿਸ ਤਰ੍ਹਾਂ ਗੱਲ ਕਰਨੀ ਉਹਨੇ ਵਿਹਾਰ ਵਿਵਹਾਰ ਠੀਕ ਨਹੀਂ ਸੀ ਉਹਦਾ ਦੂਸਰਾ ਹੈ ਕਿ ਜਦੋਂ ਮੈਂ ਉਹ ਖੋਲ੍ਹਿਆ ਚਾਰਜਰ ਮੈਂ ਤੁਹਾਡੇ ਕੋਲੋਂ ਮੰਗਵਾਇਆ ਸੀ ਵੀਵੋ ਦਾ ਉਹ ਤਾਂ ਨਿਕਲਿਆ ਦੂਸਰਾ ਕੋਈ ਦੇਸੀ ਕੰਪਨੀ ਦਾ ਅਤੇ ਹੁਣ ਉਹਦੇ 'ਚ ਵੀ ਮੈਨੂੰ ਨੁਕਸਾਨ ਇਹ ਹੋ ਰਿਹਾ ਕਿ ਹੁਣ ਮੈਂ ਜਦੋਂ ਲਗਾਇਆ ਤਾਂ ਮੇਰਾ ਫੋਨ ਡੈਮੇਜ ਹੋ ਗਿਆ ਅਤੇ ਹੁਣ ਉਸ ਫੋਨ ਡੈਮੇਜ ਦੀ ਭਰਪਾਈ ਕੌਣ ਕਰੇਗਾ ਉਹ ਤਾਂ ਹੁਣ ਤੁਸੀਂ ਕਰਨੀ ਨਹੀਂ ਮੈਂ ਹੁਣ ਇਹੀਓ ਕਹਿੰਦੀ ਹਾਂ ਕਿ ਤੁਸੀਂ ਇਹਨਾਂ ਨੂੰ ਵਾਪਸ ਲਓ ਹਾਂਜੀ ਹਾਂਜੀ ਵਾਪਸ ਮੈਂ ਵਾਪਸ ਕਰਨਾ ਚਾਹੁੰਦੀ ਹਾਂ ਕੋਈ ਹੋਰ ਤਾਂ ਤੁਹਾਡੇ ਕੋਲ ਹੋਣਾ ਨਹੀਂ ਉਹਦੇ ਨਾਲ ਦਾ ਹਾਂ ਮੈਂ ਵੀਵੋ ਦਾ ਉਹ ਲੈਣਾ ਸੀਗਾ ਨਹੀਂ ਤੁਸੀਂ ਮੇਰੇ ਪੈਸੇ ਹੀ ਵਾਪਸ ਕਰ ਦਿਉ ਹਾਂ ਠੀਕ ਹੈ ਰਿਫੰਡ ਪਾ ਦੇਣਾ ਇਹਦਾ ਠੀਕ ਆ ਜੀ ਓਕੇ